ਸਤਿ ਸ਼੍ਰੀ ਅਕਾਲ ਅੱਜ ਮੈਂ ਇੱਕ ਵਸਤੂ ਬਲੇਜ਼ਰ ਬਾਰੇ ਗੱਲ ਕਰਾਂਗਾ ਜਿਸਨੂੰ ਆਮ ਤੋਰ ਤੇ ਵਿਅਕਤੀਗਤ ਅਤੇ ਵਿਆਹਵਾਸਿਕ ਦਿਖਾਵੇ ਲਈ ਪਹਿਨਾਇਆ ਜਾਂਦਾ ਹੈ ਹਾਲਾਂਕੀ ਬਲੇਜਰ ਇੱਕ ਆਧੁਨਿਕ ਅਤੇ ਸੋਹਣੀ ਪਹਿਨਾਵਟ ਹੈ ਪਰ ਇਸ ਵਿੱਚ ਕਈ ਨੁਕਸ ਵੀ ਹਨ ਜੋ ਕੀ ਇਸ ਦੀ ਵਰਤੋਂ ਨੂੰ ਸੰਕਟਮਈ ਬਣਾ ਸਕਦੇ ਹਨ ਪਹਿਲਾ ਕੀਮਤ ਬਹੁਤ ਜਿਆਦਾ ਹੈ ਮੈਂ ਇੱਕ ਬਲੇਜ਼ਰ ਕਿਸੇ ਔਨਲਾਈਨ ਵੈਬਸਾਈਟ ਉੱਤੋਂ ਮੰਗਵਾਇਆ ਸੀ ਪਰ ਉਹਦੀਆਂ ਬਹੁਤ ਸਾਰੀਆਂ ਕਮੀਆਂ ਨਿਕਲੀਆਂ ਜਿਵੇਂ ਕੀ ਕੀਮਤ ਬਹੁਤ ਜ਼ਿਆਦਾ ਸੀ ਬਲੇਜ਼ਰ ਦੀਆਂ ਕੀਮਤਾਂ ਆਮ ਕੱਪੜਿਆਂ ਦੀ ਤੁਲਨਾ ਵਿੱਚ ਕਾਫ਼ੀ ਵੱਧ ਹੁੰਦੀ ਹੈ ਇੱਕ ਵਧੀਆ ਗੁਣਵੱਤਾ ਵਾਲਾ ਬਲੇਜਰ ਖਰੀਦਣ ਲਈ ਵਧੀਆ ਖਰਚਾ ਵੀ ਹੋਣਾ ਚਾਈਦਾ ਹੈ ਜੋ ਕੀ ਹਰ ਵਿਅਕਤੀ ਦੀ ਜੇਬ ਦੇ ਹਿਸਾਬ ਨਾਲ ਨਹੀਂ ਹੁੰਦਾ ਦੂਸਰਾ ਅਰਾਮਦਾਇਕ ਨਹੀਂ ਸੀਗਾ ਜਿੱਦਾਂ ਕੀ ਮੈਨੂੰ ਲੱਗਾ ਕੀ ਜਿਹੜਾ ਮੈਂ ਬਲੇਜਰ ਮੰਗਵਾਇਆ ਹੈ ਉਹ ਬਹੁਤ ਹੀ ਜ਼ਿਆਦਾ ਕੰਫਰਟੇਬਲ ਹੋਏਗਾ ਪਰ ਜਦੋਂ ਮੈਂ ਉਹਨੂੰ ਪਾਇਆ ਤਾਂ ਉਹ ਬਹੁਤ ਹੀ ਜ਼ਿਆਦਾ ਅਨਕੰਫਰਟੇਬਲ ਸੀਗਾ ਤੀਸਰੀ ਗੱਲ ਜਦੋਂ ਮੈਂ ਬਲੇਜ਼ਰ ਔਨਲਾਈਨ ਓਡਰ ਕੀਤਾ ਸੀਗਾ ਤਾਂ ਮੈਨੂੰ ਇਹ ਚੀਜ ਦਿਖਾਈ ਗਈ ਸੀਗੀ ਕੀ ਉਸਦਾ ਕਲਰ ਪਿਓਰ ਬਲੈਕ ਹੈ ਪਰ ਜਦੋਂ ਮੈਂ ਮੇਰਾ ਓਡਰ ਮੈਨੂੰ ਪੁੱਜਿਆ ਤਾਂ ਜਦੋਂ ਮੈਂ ਉਸਨੂੰ ਖੋਲ ਕੇ ਦੇਖਿਆ ਤਾਂ ਉਹਦਾ ਕਲਰ ਪਿਓਰ ਬਲੈਕ ਨਈਂ ਸੀਗਾ ਫੇਰ ਉਸ ਤੋਂ ਬਾਅਦ ਜਿਹੜਾ ਉਸ ਚੀਜ ਦਾ ਸਾਈਜ ਸੀਗਾ ਬਹੁਤ ਈ ਜ਼ਿਆਦਾ ਛੋਟਾ ਸੀਗਾ ਜਿਹੜਾ ਕੀ ਮੈਨੂੰ ਫਿੱਟ ਹੀ ਨਈਂ ਆਇਆ ਜਿਸ ਕਰਕੇ ਮੈਨੂੰ ਬਲੇਜ਼ਰ ਵਿੱਚ ਬਹੁਤ ਸਾਰੀਆਂ ਕਮੀਆਂ ਦਿਖੀਆਂ ਤੇ ਮੈਂ ਉਸਨੂੰ ਇੱਕ ਖਾਸ ਦਿਨ ਉੱਤੇ ਪਾਉਣਾ ਸੀਗਾ ਪਰ ਇਨ੍ਹਾਂ ਚੀਜਾਂ ਕਰਕੇ ਹੀ ਮੈਂ ਉਸਨੂੰ ਨਹੀਂ ਪਾ ਸਕਿਆ ਕਿਉਂਕੀ ਉਹਦੇ ਵਿੱਚ ਬਹੁਤ ਸਾਰੀਆਂ ਕਮੀਆਂ ਸੀਗੀਆਂ ਉਸ ਤੋਂ ਇਲਾਵਾ ਜਿਹੜੀ ਬਲੇਜ਼ਰ ਦੀ ਜੇਬ ਸੀਗੀ ਉਹਦੇ ਵਿੱਚ ਵੀ ਕੱਟ ਲੱਗੇ ਹੋਏ ਸਨ ਅਤੇ ਉਸਦੀ ਕੱਪੜੇ ਦੀ ਕੁਆਲਟੀ ਬਹੁਤ ਹੀ ਜਿਆਦਾ ਮਾੜੀ ਸੀਗੀ